ਮੇਰਾ ਨਾਮ ਹਰਮਨ ਕੌਰ ਹੈ ਮੇਰੀ ਉਮਰ ਬਾਈ ਸਾਲ ਹੈ ਅਤੇ ਮੈਂ ਸੁਖਰਾਮ ਬਾਗ ਰੂਪਨਗਰ ਦੀ ਨਿਵਾਸੀ ਹਾਂ ਮੈਂ ਬੀ ਐੱਸ ਸੀ ਮੈਡੀਕਲ ਦੀ ਪੜ੍ਹਾਈ ਕੀਤੀ ਹੋਈ ਹੈ ਅਤੇ ਉਸ ਤੋਂ ਬਾਅਦ ਮੈਂ ਕੰਪਿਊਟਰ ਅਤੇ ਐਕਾਂਊਟਿੰਗ ਦਾ ਕੋਰਸ ਕੀਤਾ ਹੈ ਅਤੇ ਹੁਣ ਮੈਂ ਡਾਕਖਾਨੇ ਦੇ ਵਿੱਚ ਆਈ ਆਈ ਟੀ ਰੂਪਨਗਰ ਵਿਖੇ ਨੌਕਰੀ ਕਰਦੀ ਹਾਂ